ਅਠਾਰਾਂ ਜਨਵਰੀ ਉੱਨੀ ਸੌ ਅਠਾਸੀ ਉਨ ਉੱਨੀ ਅਕਤੂਬਰ ਉੱਨੀ ਸੌ ਛਿਆਸੀ ਛੱਬੀ ਮਈ ਉੱਨੀ ਸੌ ਬਾਨਵੇਂ ਅੱਠ ਨਵੰਬਰ ਉੱਨੀ ਸੌ ਛਿਆਨਵੇਂ ਬਾਰ੍ਹਾਂ ਅਗਸਤ ਉੱਨੀ ਸੌ ਚੁਰਾਸੀ